ਤੇਰ੍ਹਾਂ ਮਾਰਚ ਉੱਨੀ ਸੌ ਚੁਹੱਤਰ ਇੱਕ ਨਵੰਬਰ ਉੱਨੀ ਸੌ ਉਨਾਸੀ ਅਠਾਰ੍ਹਾਂ ਦਸੰਬਰ ਦੋ ਹਜ਼ਾਰ ਅੱਠ ਸੌਲ੍ਹਾਂ ਜੂਨ ਦੋ ਹਜ਼ਾਰ ਬਾਰ੍ਹਾਂ ਬਾਰ੍ਹਾਂ ਅਗਸਤ ਦੋ ਹਜ਼ਾਰ ਉੱਨੀ